ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੈਂ ਨਾ ਦੋ ਦਿਨ ਹੋਏ ਆ ਤੁਹਾਡੇ ਇੱਥੇ ਨਾ ਨਵਾਂ ਨਵਾਂ ਸ਼ਿਫਟ ਹੋਇਆ ਵਾਂ ਅਤੇ ਮੈਨੂੰ ਨਾ ਥੋੜ੍ਹਾ ਇੱਥੋਂ ਦਾ ਨਾ ਟਰਾਂਸਪੋਰਟ ਸਿਸਟਮ ਬਾਰੇ ਸਮਝਾ ਦਿਉ ਟਰਾਂਸਪੋਰਟ ਸਿਸਟਮ ਕਿਸ ਤਰ੍ਹਾਂ ਦਾ ਹੈਗਾ ਇੱਥੋਂ ਦਾ ਹਾਂਜੀ ਮੈਂ ਘੁੰਮਣਾ ਫਿਰਨਾ ਚਾਹੁੰਦਾ ਪਰ ਮੈਨੂੰ ਇੱਥੋਂ ਦਾ ਕੁਝ ਨਾ ਕੁਝ ਨੌਲੇਜ ਨਹੀਂ ਕੋਈ ਗਾਈਡ ਨਹੀਂ ਹੈਗਾ ਹਾਲੇ ਪੂਰੀ ਤਰ੍ਹਾਂ ਕਿ ਇੱਥੋਂ ਦਾ ਟਰਾਂਸਪੋਰਟ ਸਿਸਟਮ ਕਿਸ ਤਰ੍ਹਾਂ ਦਾ ਹੈਗਾ ਵਾ ਅੱਛਾ ਅੱਛਾ ਅੱਛਾ ਜੀ

ਠੀਕ ਆ ਠੀਕ ਆ ਜੀ ਠੀਕ ਆ ਸਰ ਚਲੋ ਠੀਕ ਹੈ ਜੀ ਠੀਕ ਹੈ ਸਰ ਚਲੋ ਓਕੇ ਫਿਰ ਨਾ ਮੈਂ ਤੁਹਾਨੂੰ ਨਾ ਸ਼ਾਮ ਨੂੰ ਮਿਲਣਾ ਫਿਰ ਹੈਂ ਸਰ ਓਕੇ ਜੀ ਠੀਕ ਆ ਸਰ ਥੈਂਕ ਯੂ ਥੈਂਕ ਯੂ ਸਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਓਕੇ ਓਕੇ ਥੈਂਕ ਯੂ ਜੀ